ਮੈਂ ਪੋਲਟਰੀ ਪਾਲਕ ਆਪਣੇ ਮੁਰਗੀਆਂ ਲਈ ਪ੍ਰਜਨਨ ਪ੍ਰੋਗਰਾਮ ਦਾ ਪ੍ਰਬੰਧ ਕਰਦੇ ਸਮੇਂ ਸਾਥੀਆਂ ਦੀ ਚੋਣ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖਦੀ ਹਾਂ ਕਿ ਕਿ ਕਿਸੇ ਨੂੰ ਕੋਈ ਬਿਮਾਰੀ ਤਾਂ ਨਹੀਂ ਕਿਉਂਕਿ ਬਰੀਡਿੰਗ ਸਮੇਂ ਜੇ ਕਿਸੀ ਇੱਕ ਨੂੰ ਬਿਮਾਰੀ ਹੁੰਦੀ ਹੈ ਤਾਂ ਉਹ ਸਹੀ ਨਹੀਂ ਹੁੰਦਾ ਇਸ ਲਈ ਇਹਨਾਂ ਗੱਲਾਂ ਦਾ ਮੈਂ ਖ਼ਾਸ ਤੌਰ 'ਤੇ ਧਿਆਨ ਰੱਖਦੀ ਹਾਂ ਅਤੇ ਛੋਟੇ ਅਤੇ ਨੌਜਵਾਨ ਜਾਨਵਰਾਂ ਦੀ ਦੇਖਭਾਲ ਵੀ ਮੈਂ ਬਹੁਤ ਧਿਆਨ ਨਾਲ ਕਰਦੀ ਹਾਂ ਉਹਨਾਂ ਦੀ ਦੇਖ ਸੰਭਾਲ ਮੇਰੇ ਲਈ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਛੋਟਿਆਂ ਨੂੰ ਸਾਂਭਣਾ ਇੱਕ ਵੱਡੀ ਚੁਣੌਤੀ ਹੁੰਦੀ ਹੈ ਉਹਨਾਂ ਨੂੰ ਮੈਂ ਚਾਰਾ ਅਤੇ ਉਹਨਾਂ ਨੂੰ ਰੱਖਣਾ ਇੱਕ ਅਲੱਗ ਤਰ੍ਹਾਂ ਹੀ ਕਰਦੀ ਹਾਂ ਅਤੇ ਜਿਹੜਾ ਮੇਰਾ ਸ਼ੈਡਿਊਲ ਹੁੰਦਾ ਹੈ ਉਸ ਸਮੇਂ 'ਤੇ ਹੀ ਉਹਨਾਂ ਨੂੰ ਚਾਰਾ ਦਿੰਦੀ ਹਾਂ